ਸਾਡੇ ਭਾਰਤ ਵਿੱਚ ਸਿਹਤ ਸੰਭਾਲ ਪ੍ਰਣਾਲੀ ਜਿਹੜੀ ਹੈਗੀ ਹੈ ਉਹ ਕਾਫੀ ਹੱਦ ਤੱਕ ਠੀਕ ਹੈ ਮਗਰ ਹਜੇ ਉਸਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਦੀ ਜ਼ਰੂਰਤ ਹੈ ਕਿਉਂਕਿ ਕੁਝ ਦੇਸ਼ਾਂ ਦੇ ਨਾਲੋ ਇਹ ਕਾਫੀ ਅੱ ਚੰਗੀ ਹੈ ਲੇਕਿਨ ਜਿਹੜੇ ਕੁਝ ਬਹੁਤ ਹੀ ਜ਼ਿਆਦਾ ਵਿਕਸਿਤ ਦੇਸ਼ ਨੇ ਉਹਨਾਂ ਦੇ ਮੁਕਾਬਲੇ ਵਿੱਚ ਹਜੇ ਕਾਫੀ ਪਿੱਛੇ 'ਚ ਜਾ ਰਹੀ ਹੈ ਅੱਜ ਦੀ ਸਿਹਤ ਪ੍ਰਣਾਲੀ ਅਸੀ ਦੇਖਦੇ ਹਾਂ ਕਿ ਸਾਡੇ ਜਿਹੜੇ ਆਸ ਪਾਸ ਜੇ ਸਾਨੂੰ ਕੀਤੇ ਜਾਣਾ ਪਵੇ ਸਾਡੇ ਸਿਹਤ ਦੇ ਜਿਹੜੇ ਕਲੀਨਿਕ ਹੁੰਦੇ ਹਨ ਤਾਂ ਉੱਥੇ ਸਾਨੂੰ ਬਹੁਤ ਸਾਰੀਆਂ ਜਿਵੇਂ ਆਮ ਲੋਕ ਹੈ ਓਹ ਜ਼ਿਆਦਾਤਰ ਸਰਕਾਰੀ ਸਿਹਤ ਵਿਭਾਗਾਂ ਵਿੱਚ ਹੀ ਜਾਣਾ ਨੂੰ ਪਹਿਲ ਦਿੰਦੇ ਹਨ ਕਿਉਂਕਿ ਜਿਹੜੇ ਪ੍ਰਾਈਵੇਟ ਹੁੰਦੇ ਹਨ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਦੀ ਜਿਹੜੀ ਹੈਗੀ ਫੀਸ ਹੁੰਦੀ ਹੈ ਜਿਹੜੇ ਕੀ ਉਹ ਨਹੀਂ ਦੇ ਸਕਦੇ ਪਰ ਉੱਥੇ ਉਹਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਲੰਬੀ ਲਾਈਨ ਦੇ ਵਿੱਚ ਲੱਗਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਉੱਥੇ ਸਾਫ਼ ਸਫ਼ਾਈ ਵੀ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਘੱਟ ਹੀ ਦੇਖਣ ਨੂੰ ਮਿਲਦੀ ਹੈ ਅਤੇ ਇਹਨਾਂ ਜਿਹੜੇ ਹਸਪਤਾਲਾਂ ਦੀ ਸਮਰੱਥਾ ਹੁੰਦੀ ਹੈ ਉਹ ਵੀ ਕਈ ਵਾਰੀ ਬਹੁਤ ਘੱਟ ਹੁੰਦੀ ਹੈ ਅਤੇ ਜਿਹੜਾ ਮਰੀਜ਼ ਹੁੰਦਾ ਹੈ ਉਸਨੂੰ ਕਈ ਵਾਰੀ ਨਿਰਾਸ਼ ਹੀ ਘਰ ਵਾਪਿਸ ਆਉਣਾ ਪੈਂਦਾ ਹੈ ਅਤੇ ਉਸਨੂੰ ਉੱਥੇ ਬੈੱਡ ਜਿਹੜਾ ਨਹੀਂ ਮਿਲਦਾ ਹੈ ਇਸ ਕਰਕੇ ਇਹਨਾਂ ਜਿਹੜੇ ਸਰਕਾਰੀ ਵਿਭਾਗ ਹਨ ਸਿਹਤ ਦੇ ਇਹਨਾਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਸੁਧਾਰ ਕਰਨੇ ਚਾਹੀਦੇ ਹਨ ਤਾਂ ਕਿ ਜੋ ਇੱਕ ਆਮ ਨਾਗਰਿਕ ਹੈ ਉਹ ਵੀ ਆਪਣੀਆਂ ਸਿਹਤ ਸਹੂਲਤਾਵਾਂ ਜਿਹੜੀਆਂ ਹੈਗੀਆਂ ਉਹ ਜੋ ਉਸਦਾ ਬਣਦਾ ਅਧਿਕਾਰ ਹੈ ਉਸਨੂੰ ਪ੍ਰਾਪਤ ਕਰ ਸਕੇ